ਸਤਿ ਸ਼੍ਰੀ ਅਕਾਲ ਜੀ ਸਵਿਗੀ ਕਸਟਮਰ ਕੇਅਰ ਤੋਂ ਬੋਲ ਰਹੇ ਹੋ ਹਾਂਜੀ ਮੈਂ ਰੁਪਿੰਦਰ ਕੌਰ ਬੋਲ ਰਹੀ ਹਾਂ ਮੈਂ ਤੁਹਾਡੇ ਕੋਲ ਦੋ ਘੰਟੇ ਪਹਿਲਾਂ ਇੱਕ ਔਡਰ ਦਿੱਤਾ ਸੀ ਜੀ ਹਾਂਜੀ ਔਡਰ ਨੰਬਰ ਬਾਰ੍ਹਾਂ ਹੈ ਜੀ ਹਾਂਜੀ ਸਰ ਉਹਦੇ ਵਿੱਚ ਮੈਂ ਕੁਛ ਭੋਜਨ ਦੇ ਕੁਛ ਉਹਦ ਆਈਟਮਸ ਕਹੀਆਂ ਸੀ ਜਿਵੇਂ ਕਿ ਦਸ ਰੋਟੀਆਂ ਇੱਕ ਮਿਕਸ ਵੈੱਜ ਦਹੀਂ ਮਟਰ ਪਨੀਰ ਹਾਂਜੀ ਅਤੇ ਉਹ ਉਹਦੇ ਵਿੱਚ ਮੈਂ ਕੁਛ ਪੀਣ ਵਾਲੇ ਪਦਾਰਥ ਹੋਰ ਜਿ ਹੋਰ ਉਹ ਕਰਨਾ ਚਾਹੁੰਦੀ ਹਾਂ ਹੋਰ ਐਡ ਕਰਨਾ ਚਾਹੁੰਦੀ ਹਾਂ ਹਾਂਜੀ ਜਿੱਦਾਂ ਕਿ ਕੋਕ ਹੋ ਗਿਆ ਜੂਸ ਹੋ ਗਿਆ ਹਾਂਜੀ ਕੋਕੋਨਟ ਵਾਟਰ ਹੋ ਗਿਆ ਹਾਂਜੀ ਅਤੇ ਉਹਦੇ ਨਾਲ ਇੱਕ ਮੈਂ ਮੱਖਣ ਵੀ ਉਹਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੀ ਹਾਂ ਜੀ ਹਾਂਜੀ ਕੀ ਤੁਸੀਂ ਦੱਸ ਸਕਦੇ ਹੋ ਜੀ ਕਿ ਹੋਰ ਤੁਹਾਡੇ ਕੋਲ ਕਿਹੜੇ ਕਿਹੜੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਤੁਹਾਡੇ ਕੋਲ ਪੀਣ ਵਾਲੇ ਪਦਾਰਥ ਨੇ ਜੀ ਠੀਕ ਹੈ ਜੀ ਠੀਕ ਹੈ ਸਰ ਉਹਦੇ ਵਿੱਚੋਂ ਤੁਸੀਂ ਜੀ ਫਿਰ ਇੱਕ ਔਰਿਜ ਜੂਸ ਵੀ ਦੇ ਦਿਓ ਜੀ ਹਾਂਜੀ ਅਤੇ ਮੱਖਣ ਦੀਆਂ ਦੋ ਹਾਂਜੀ ਅਮੁਲ ਵਾਲਾ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਕਦੋਂ ਤੱਕ ਮੈਨੂੰ ਜੀ ਇਹ ਮੇਰਾ ਔਡਰ ਮਿਲ ਜਾਵੇਗਾ ਠੀਕ ਹੈ ਸਰ ਠੀਕ ਹੈ ਜੀ ਓਕੇ ਜੀ ਓਕੇ ਧੰਨਵਾਦ ਜੀ